ਭਾਰਤ ਵਿੱਚ ਭਾਰਤ ਉੱਦਮੀ ਲਈ ਇੱਕ ਉੱਭਰਦੇ ਯੁੱਗ ਦਾ ਬਹੁਤ ਜ਼ਿਆਦਾ ਆਨੰਦ ਮਾਣ ਰਿਹਾ ਕਿਉਂਕਿ ਇਹਦੇ ਵਿੱਚ ਨਵੇਂ ਨੌਜਵਾਨਾਂ ਵਾਸਤੇ ਯੂਥ ਵਾਸਤੇ ਜਿਹੜੇ ਕਾਰੋਬਾਰ ਹੈ ਉਹ ਬਹੁਤ ਘੱਟ ਪ੍ਰਸੈਂਟੇਜ 'ਤੇ ਦਰਾਂ 'ਤੇ ਮਿਲਦਾ ਅਤੇ ਲੋਨ ਮਿਲਦਾ ਜਿਸ ਨਾਲ ਉਹ ਆਪਣਾ ਕੰਮ ਕਾਰ ਸ਼ੁਰੂ ਕਰ ਸਕਦੇ ਐਂ ਜਾਂ ਕਿਸੇ ਵੀ ਤਰ੍ਹਾਂ ਦਾ ਆਈ ਟੀ ਆਈ ਆਈ ਆਈ ਆਈ ਟੀ ਆਈ ਪ੍ਰੋਫੈਸ਼ਨਲ ਕੰਮ ਹੋਵੇ ਜਾਂ ਗਾਵਾਂ ਮੱਝਾਂ ਦਾ ਫਾਰਮ ਬੱਕਰੀਆਂ ਦਾ ਫਾਰਮ ਪਿੱਗ ਫਾਰਮ ਜਾਂ ਟੈਕਸੀ ਸਰਵਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਉਹ ਸ਼ੁਰੂ ਕਰ ਸਕਦਾ ਭਾਰਤ ਦੇ ਵਿੱਚ ਇਸ ਤਰਾਂ ਦੇ ਬਹੁਤ ਜ਼ਿਆਦਾ ਲੋਨਸ ਸੁਵਿਧਾ ਬਹੁਤ ਜ਼ਿਆਦਾ ਹੈਗੀਆਂ ਜਿਹੜਾ ਕਿ ਆਪਣਾ ਕੰਮ ਨੌਜਵਾਨ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ